ਹਾਂਜੀ ਗੇਮਸ ਵੀਡੀਓ ਗੇਮਸ ਦਾ ਵੀ ਮੈਂ ਕਾਫੀ ਵੱਡਾ ਸ਼ੌਕੀਨ ਰਹਿ ਚੁੱਕਿਆ ਹੁਣ ਟਾਈਮ ਦੇ ਨਾਲ ਐਹ ਸ਼ੌਕ ਚਲਾ ਗਿਆ ਲੇਕਿਨ ਮੈਨੂੰ ਹਜੇ ਵੀ ਮਤਲਬ ਮੈਂ ਕਾਫੀ ਬੱਚੇ ਦੇਖਦਾ ਆਸ ਪਾਸ ਜੋ ਕਿ ਵੀਡੀਓ ਗੇਮਸ ਖੇਡਦੇ ਹਾਂ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਵੀਡੀਓ ਗੇਮਸ ਕਿਹੜੀਆਂ ਖੇਡਦੇ ਹਾਂ ਤਾਂ ਉਹਨਾਂ ਵਿੱਚ ਡਰਾਈਵਿੰਗ ਮਲਟੀਪਲੇਅਰ ਜਾਂ ਫਾਈਟਿੰਗ ਹੋ ਗਈਆਂ ਬੈਟਲ ਗਰਾਊਂਡ ਗੇਮਸ ਕਾਫੀ ਨੇ ਕਿਉਂਕਿ ਅੱਜ ਕੱਲ੍ਹ ਹਾਲ ਹੀ ਵਿੱਚ ਪਬਜੀ ਫਰੀ ਫਾਇਰ ਵਰਗੀਆਂ ਗੇਮਜ਼ ਕਾਫੀ ਚੱਲਦੀਆਂ ਨੇ ਅਤੇ ਹਾਂਜੀ ਮੈਂ ਵੀ ਮਤਲਬ ਪਬਜੀ ਖੇਡਦਾ ਰਿਹਾ ਸੀ ਪਹਿਲਾਂ ਤਾਂ ਇਹਨਾਂ ਵਿੱਚ ਪਬਜੀ ਵਿੱਚ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗਦੀ ਸੀਗੀ ਕਿ ਤੁਸੀਂ ਆਪਣੇ ਤੋਂ ਇਲਾਵਾ ਕਿਸੇ ਹੋਰ ਨਾਲ ਗੱਲ ਕਰਦੇ ਹੋ ਗੇ ਔਨਲਾਈਨ ਫਰੈਂਡਸ ਬਣਾਉਂਦੇ ਹੋ ਜੋ ਕਿ ਤੁਹਾਨੂੰ ਅੱਗੇ ਜਾ ਕੇ ਵਧੀਆ ਸੁਜੈਸ਼ਨਜ਼ ਵੀ ਦੇ ਸਕਦੇ ਆ ਅਤੇ ਤੁਹਾਨੂੰ ਹਰ ਚੀਜ਼ 'ਚ ਸਪੋਰਟ ਵੀ ਕਰਦੇ ਨੇ ਅਤੇ ਕਾਫੀ ਵਾਰ ਇੱਦਾਂ ਹੁੰਦਾ ਕਿ ਇਹ ਚੀਜ਼ ਤੁਹਾਨੂੰ ਮੈਂਟਲ ਮੈਂਟਲ ਸਟਰੈਸ ਦਿੰਦੀਆਂ ਨੇ ਕਈ ਵਾਰ ਇਹ ਤੁਹਾਨੂੰ ਡਿਪਰੈਸ਼ਨ 'ਚੋਂ ਬਾਹਰ ਕੱਢ ਸਕਦੀਆਂ ਨੇ ਕਈ ਵਾਰ ਇਹ ਡਿਪਰੈਸ਼ਨ ਦੇ ਵਿੱਚ ਲਿਆ ਸਕਦੀਆਂ ਨੇ ਅਤੇ ਇਹੀ ਚੀਜ਼ ਹੈ ਕਿ ਜਿਹੜੀ ਗੇਮਸਜ਼ ਨੇ ਇਹਨਾਂ ਨੂੰ ਗੇਮ ਦੀ ਤਰ੍ਹਾਂ ਹੀ ਵੇਖਣਾ ਚਾਹੀਦਾ ਅਤੇ ਜ਼ਿਆਦਾ ਵੀ ਨਹੀਂ ਅਤੇ ਮਤਲਬ ਘੱਟ ਵੱਧ ਹੀ ਖੇਡੀਆਂ ਤਾਂ ਚੰਗਾ ਕਿਉਂਕਿ ਇਹ ਚੀਜ਼ ਮੈਂਟਲੀ ਇੰਪੈਕਟ ਕਾਫੀ ਜ਼ਿਆਦਾ ਕਰਦੀਆਂ ਨੇ